ਹੈਲੋ ਭਾਅ ਜੀ ਅਸੀਂ ਤੁਹਾਡੀ ਗੱਡੀ ਬੁੱਕ ਕੀਤੀ ਸੀ ਚੰਡੀਗੜ੍ਹ ਜਾਣ ਲਈ ਤੁਸੀਂ ਸਵੇਰੇ ਟਾਈਮ ਟਾਈਮ 'ਤੇ ਆ ਜਾਓਗੇ ਅੱਛਾ ਰਸਤੇ ਵਿੱਚ ਕਿੱਥੇ ਕਿੱਥੇ ਟਰੈਫ਼ਿਕ ਹੁੰਦੀ ਹੈ ਦੱਸ ਦਿਓ ਹੋਰ ਕੋਈ ਰਸਤਾ ਸੌਖਾ ਹੈ ਜਿੱਥੇ ਅਸੀਂ ਚੰਡੀਗੜ੍ਹ ਜਲਦੀ ਪੁੱਜ ਜਾਈਏ